ਵੈਸੇ ਤਾਂ ਮੈਨੂੰ ਫ਼ਲ ਫੁੱਲ ਅਤੇ ਸਬਜ਼ੀਆਂ ਤਿੰਨੋਂ ਉਗਾਉਣੀਆਂ ਚੰਗੀਆਂ ਲੱਗਦੀਆਂ ਹਨ ਪਰ ਅਗਰ ਕਿਸੇ ਇੱਕ ਦੀ ਗੱਲ ਕੀਤੀ ਜਾਵੇ ਤਾਂ ਮੈਨੂੰ ਫ਼ਲਾਂ ਦੇ ਪੌਦੇ ਹੀ ਲਗਾਉਣਾ ਜ਼ਿਆਦਾ ਚੰਗਾ ਲੱਗਦਾ ਹੈ ਕਿਉਂਕਿ ਫ਼ਲ ਦਾ ਬੂਟਾ ਸਾਨੂੰ ਲੰਬੇ ਸਮੇਂ ਤੱਕ ਫ਼ਲ ਦਿੰਦਾ ਰਹਿੰਦਾ ਹੈ ਅਤੇ ਅਸੀਂ ਬਿਨਾ ਮਿਹਨਤ ਕੀਤੇ ਪੰਜ ਤੋਂ ਲੈ ਕੇ ਛੇ ਸਾਲ ਤੱਕ ਉਸਦੇ ਫ਼ਲ ਖਾ ਸਕਦੇ ਹਾਂ